ਹਾਂ ਮੈਂ ਇੱਕ ਦਿਨ ਇੱਕ ਚਿੱਤਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਘਰ ਪਏ ਕੁਝ ਰੰਗ ਲਏ ਅਤੇ ਇੱਕ ਪੇਪਰ 'ਤੇ ਕੁਝ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਇਸ ਤਰ੍ਹਾਂ ਦੀ ਕੋਈ ਤਸਵੀਰ ਬਣਾਉਣਾ ਚਾਹੁੰਦੀ ਸੀ ਜੋ ਦੇਖਣ ਵਿੱਚ ਵੀ ਸੋਹਣੀ ਲੱਗੇ ਅਤੇ ਸਾਡੇ ਸੱਭਿਆਚਾਰ ਨਾਲ ਵੀ ਜੁੜੀ ਹੋਵੇ ਫਿਰ ਮੈਂ ਸੋਚਿਆ ਕਿ ਮੈਂ ਚਰਖਾ ਕੱਤਦੀਆਂ ਮੁਟਿਆਰਾਂ ਦੀ ਤਸਵੀਰ ਬਣਾਵਾਂ ਪਰ ਮੈਂ ਸ ਮੈਨੂੰ ਲੱਗ ਨਹੀਂ ਰਿਹਾ ਸੀ ਕੀ ਮੈਂ ਉਹ ਤਸਵੀਰ ਬਣਾ ਸਕਾਂਗੀ ਤਾਂ ਫਿਰ ਮੈਨੇ ਹੌਲੀ ਹੌਲੀ ਉਹ ਤਸਵੀਰ ਬਣਾਈ ਅਤੇ ਉਹਦੇ ਵਿੱਚ ਰੰਗ ਭਰਨੇ ਸਟਾਰਟ ਕੀਤੇ ਜਦੋਂ ਉਹ ਪੂਰੀ ਤਰਾਂ ਬਣ ਗਈ ਤਾਂ ਮੈਨੂੰ ਉਹ ਤਸਵੀਰ ਬਹੁਤ ਸੋਹਣੀ ਲੱਗੀ ਤਾਂ ਇਸ ਕਰਕੇ ਮੈਂ ਉਹ ਤਸਵੀਰ ਆਪਣੇ ਘਰਦਿਆਂ ਨੂੰ ਦਿਖਾਈ ਤਾਂ ਮੇਰੇ ਘਰਦਿਆਂ ਨੂੰ ਵੀ ਉਹ ਤਸਵੀਰ ਬਹੁਤ ਚੰਗੀ ਲੱਗੀ ਅਤੇ ਮੈਨੂੰ ਉਹਨਾਂ ਨੇ ਬਹੁਤ ਮੇਰੀ ਉਹਨਾਂ ਨੇ ਬਹੁਤ ਪ੍ਰਸੰਸਾ ਕੀਤੀ ਅਤੇ ਫਿਰ ਉਸ ਤੋਂ ਬਾਅਦ ਮੈਂ ਉਹ ਤਸਵੀਰ ਆਪਣੇ ਸਕੂਲ ਦੇ ਵਿੱਚ ਲੈ ਗਈ ਅਤੇ ਉੱਥੇ ਆਪਣੇ ਟੀਚਰਸ ਨੂੰ ਦਿਖਾਈ ਤਾਂ ਮੇਰੇ ਟੀਚਰਾਂ ਨੂੰ ਵੀ ਉਹ ਬਹੁਤ ਪਸੰਦ ਆਈ ਅਤੇ ਮੇਰੇ ਟੀਚਰਾਂ ਨੇ ਮੇਰੀ ਬਹੁਤ ਤਾਰੀਫ਼ ਕੀਤੀ ਤਾਂ ਮੈਨੇ ਤਾਂ ਉਹ ਤਸਵੀਰ ਮੇਰੀ ਟੀਚਰਾਂ ਨੇ ਕਲਾਸ ਦੇ ਵਿੱਚ ਲਗਾ ਦਿੱਤੀ ਅਤੇ ਬਹੁਤ ਮੇਰੀ ਪ੍ਰਸ਼ੰਸਾ ਕਰਕੇ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਧੰਨਵਾਦ